ਹਾਂਜੀ ਅੱਜ ਦਾ ਮੇਨ ਮੁੱਦਾ ਇਹ ਹੈ ਜੋ ਕਿ ਸਮਾਜ ਵਿੱਚ ਵੱਧ ਰਿਹਾ ਅਪਰਾਧ ਅਪਰਾਧ ਸਮਾਜ ਲਈ ਬਹੁਤ ਹਾਨੀਕਾਰਕ ਹੈ ਅਪਰਾਧ ਕਈ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਕਿ ਚੋਰੀ ਡਕੈਤੀ ਯੋਨ ਸ਼ੋਸ਼ਣ ਬੱਚਿਆਂ ਨੂੰ ਮਾਰਨਾ ਘਰੇਲੂ ਝਗੜੇ ਰੇਪ ਵਗੈਰਾ ਅਤੇ ਸਰਕਾਰ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਯਾਰ ਜਦੋਂ ਚੋਰੀ ਹੁੰਦੀ ਹੈ ਤਾਂ ਇੱਕ ਬੰਦੇ ਦੀ ਸ ਜਿੰਨੀ ਵੀ ਜ਼ਿੰਦਗੀ ਦੀ ਪੂਰੀ ਜਮ੍ਹਾਂ ਪੂੰਜੀ ਹੁੰਦੀ ਹੈ ਉਹ ਸਭ ਚੋਰੀ ਹੋ ਜਾਂਦੀ ਹੈ ਅਤੇ ਜਦੋਂ ਕਿਸੇ ਦਾ ਕਤਲ ਹੁੰਦਾ ਹੈ ਤਾਂ ਤਾਂ ਚੱਲ ਬੰਦੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਉਹ ਤਾਂ ਮਰ ਜਾਂਦਾ ਪਰ ਪਿੱਛੇ ਜਿਹੜੇ ਉਹਦੇ ਰਹਿ ਜਾਂਦੇ ਨੇ ਪਰਿਵਾਰ ਵਾਲੇ ਉਹਨਾਂ 'ਤੇ ਬੜਾ ਹੀ ਗੰਦਾ ਬੀਤਦਾ ਹੈ ਉਹ ਤੋਂ ਬਾਅਦ ਰੇਪ ਰੇਪ ਤਾਂ ਕੱਦਾ ਜਿਹਾ ਸਮਾਜ ਦਾ ਦੁਸ਼ਮਣ ਹੈ ਕਿ ਜੇ ਤੇ ਬੱਚੀ ਦਾ ਰੇਪ ਹੁੰਦਾ ਤਾਂ ਉਹਦੀ ਜ਼ਿੰਦਗੀ ਉਹਦੇ ਨਾਲ ਨਾਲ ਉਹਦੇ ਘਰ ਪਰਿਵਾਰ ਇਸ ਦੌਰਾਨ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਉਹ 'ਤੇ ਇੱਕ ਧੱਬਾ ਲੱਗ ਜਾਂਦਾ ਹੈ ਅਤੇ ਘਰੇਲੂ ਝਗੜੇ ਤਾਂ ਹੁੰਦੇ ਰਹਿੰਦੇ ਨੇ ਜਿਵੇਂ ਕਿ ਬੱਚੇ ਨੇ ਪਿਓ ਨੂੰ ਮਾਰਿਆ ਪਿਓ ਨੇ ਬੇਟੀ ਨੂੰ ਮਾਰਿਆ ਮਾਂ ਨੇ ਬਾਪ ਨੂੰ ਮਾਰਿਆ ਅਤੇ ਸਰਕਾਰ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਇਹਨਾਂ ਨੂੰ ਰੋਕਿਆ ਜਾਵੇ ਅਤੇ ਇਸ ਕਰਕੇ ਸਰਕਾਰ ਨੂੰ ਇੱਕ ਕੈਂਪ ਵਗੈਰਾ ਸ਼ੁਰੂ ਕਰਨੇ ਚਾਹੀਦੇ ਨੇ ਪਿੰਡਾਂ 'ਚ ਸਕੂਲਾਂ 'ਚ ਪਹਿਲੇ ਸਭ ਤੋਂ ਪਹਿਲੇ ਤਾਂ ਇਹਨਾਂ ਨੂੰ ਪਿੰਡਾਂ ਜਾਂ ਸਕੂਲਾਂ 'ਚ ਆਉਣਾ ਚਾਹੀਦਾ ਹੈ ਸਕੂਲਾਂ ਵਿੱਚ ਜਾ ਕੇ ਛੋਟੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਨਹੀਂ ਇਹ ਸਭ ਗਲਤ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਹਰ ਕੋਈ ਧੀ ਭੈਣ ਭਰਾ ਹੀ ਹੁੰਦੇ ਨੇ ਅਤੇ ਇਸ ਕੁਛ ਕਰਨ ਨਾਲ ਕੁਛ ਨਹੀਂ ਮਿਲਣਾ ਬਸ ਜ਼ਿੰਦਗੀ ਖਰਾਬ ਹੁੰਦੀ ਹੈ ਜੇ ਇੱਕ ਬੰਦਾ ਫੜਿਆ ਜਾਵੇ ਤਾਂ ਬਸ ਉਹਨੂੰ ਜੇਲ੍ਹ ਹੁੰਦੀ ਹੈ ਉਹਦੀ ਜ਼ਿੰਦਗੀ ਖਤਮ ਉਹਦੇ ਪਰਿਵਾਰ ਦੀ ਵੀ ਜ਼ਿੰਦਗੀ ਵਗੈਰਾ ਸਭ ਖਤਮ ਹੋ ਜਾਂਦੀ ਹੈ ਅਤੇ ਚੋਰੀ ਬਾਰੇ ਇਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਚੋਰੀ ਕਰਕੇ ਕੁਛ ਨਹੀਂ ਮਿਲਦਾ ਆਪਣਾ ਹੱਕ ਦਾ ਕਮਾਉ ਅਤੇ ਹੱਕ ਦਾ ਖਾਉ ਇਸ ਤਰ੍ਹਾਂ ਜ਼ਿੰਦਗੀ ਵਧੀਆ ਰਹੇਗੀ ਅਤੇ ਸਮਾਜ ਵਿੱਚ ਤੁਹਾਨੂੰ ਇੱਜ਼ਤ ਵੀ ਬਹੁਤ ਮਿਲੇਗੀ ਅਤੇ ਸਰਕਾਰ ਨੂੰ ਇਹ ਵੀ ਕਰਨਾ ਚਾਹੀਦਾ ਹੈ ਕਿ ਸਕੂਲਾਂ ਵਿੱਚ ਇੱਕ ਨਾ ਇੱਕ ਕਿਤਾਬ ਨਵੀਂ ਲਵਾਉਣੀ ਚਾਹੀਦੀ ਹੈ ਜੋ ਕਿ ਕ੍ਰਾਈਮ ਨੂੰ ਰੋਕੀ ਜਾਵੇ ਮਤਲਬ ਕਿ ਕੋਈ ਵੀ ਅਪਰਾਧ ਵਗੈਰਾ ਨਾ ਹੋਵੇ ਅਤੇ ਵੱਧ ਤੋਂ ਵੱਧ ਸਾਨੂੰ ਵੀ ਸਪੋਰਟ ਕਰਨਾ ਚਾਹੀਦਾ ਹੈ ਸਰਕਾਰ ਨੂੰ ਕਿ ਆਪਾਂ ਵੀ ਕੋਈ ਜੇ ਕੁਛ ਗਲਤ ਵੇਖਦੇ ਹਾਂ ਤਾਂ ਪੁਲਿਸ ਵਗੈਰਾ ਨੂੰ ਫੋਨ ਕੀਤਾ ਜਾ ਸਕੇ ਅਤੇ ਇੱਕ ਪਰ ਅਪਰਾਧ ਇਹ ਵੀ ਹੈ ਕਿ ਪੁਲਿਸ ਵਾਲੇ ਪੈਸੇ ਖਾ ਕੇ ਅਤੇ ਛੱਡ ਦਿੰਦੇ ਨੇ ਚੋਰਾਂ ਨੂੰ ਸਾਨੂੰ ਥੋੜ੍ਹਾ ਉਹ ਵੀ ਕਰਨਾ ਚਾਹੀਦਾ ਕਿ ਪੁਲਿਸ ਵਾਲਿਆਂ 'ਤੇ ਵੀ ਧਿਆਨ ਰੱਖੇ ਹਰ ਪੁਲਿਸ ਸਟੇਸ਼ਨ 'ਚ ਕੈਮਰੇ ਵਗੈਰਾ ਲੱਗਣ ਤਾਂ ਕਿ ਜੋ ਉਹ ਵੀ ਰਿਸ਼ਵਤ ਲੈਣਾ ਘੱਟ ਕਰਨ ਅਤੇ ਸਮਾਜ ਨੂੰ ਇੱਕ ਵਧੀਆ ਸਮਾਜ ਬਣਾਈਏ ਅਤੇ ਮੇਨ ਇਹੀ ਹੈ ਕਿ ਕੈਂਪ ਵਗੈਰਾ ਸ਼ੁਰੂ ਕਰਨੇ ਚਾਹੀਦੇ ਹੈ ਅਤੇ ਹਰ ਇੱਕ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਇਹ ਸਭ 'ਚ ਕੁਛ ਨਹੀਂ ਰੱਖਿਆ ਸਭ ਬੇਕਾਰ ਹੈ